ਮੈਂ ਤੁਹਾਨੂੰ ਆਪਣੀ ਇੱਕ ਗਲਤੀ ਬਾਰੇ ਦੱਸਣਾ ਚਾਹੁੰਦੀ ਹਾਂ ਅਤੇ ਉਸਨੂੰ ਮੈਂ ਕਿਵੇਂ ਕੀਤਾ ਸੀ ਅਤੇ ਕਿਵੇਂ ਸੰਭਾਲਿਆ ਸੀ ਅਤੇ ਜਦੋਂ ਮੈਂ ਸਕੂਲ ਜਾਂਦੀ ਹੁੰਦੀ ਸੀ ਅਤੇ ਉਦੋਂ ਮੇਰੇ ਤੋਂ ਹੋਮਵਰਕ ਨਹੀਂ ਮੈਂ ਕਰਕੇ ਗਈ ਸੀ ਸਕੂਲ ਦਾ ਅਤੇ ਉਸ ਤੋਂ ਬਾਅਦ ਜਦੋਂ ਮੈਂ ਸਕੂਲ ਗਈ ਅਗਲੇ ਦਿਨ ਤਾਂ ਮੇਰੇ ਟੀਚਰ ਨੇ ਪੁੱਛਿਆ ਕਿ ਤੂੰ ਹੋਮਵਰਕ ਕਿਉਂ ਨਹੀਂ ਕਰਕੇ ਆਈ ਅੱਜ ਤਾਂ ਮੈਂ ਟੀਚਰ ਨੂੰ ਦੱਸਿਆ ਕਿ ਕੱਲ੍ਹ ਮੇਰੇ ਘਰ ਦੇ ਵਿੱਚ ਫੰ ਫੰਕਸ਼ਨ ਸੀ ਉਹਦੇ ਵਿੱਚ ਮੈਂ ਬਹੁਤ ਜ਼ਿਆਦਾ ਬਿਜ਼ੀ ਹੋ ਗਈ ਸੀ ਅਤੇ ਘਰ ਵਿੱਚ ਕਾਫੀ ਰਿਸ਼ਤੇਦਾਰ ਆਏ ਹੋਏ ਸੀ ਇਸ ਕਰਕੇ ਮੈਂ ਹੋਮਵਰਕ ਨਹੀਂ ਕਰ ਪਾਈ ਅਤੇ ਉਸ ਦਿਨ ਟੀਚਰ ਨੂੰ ਵੀ ਮੇਰੀ ਗਲਤੀ 'ਤੇ ਵਿਸ਼ਵਾਸ ਹੋ ਗਿਆ ਅਤੇ ਉਹਨਾਂ ਨੇ ਮੇਰੀ ਗੱਲ ਮੰਨ ਲਈ ਅਤੇ ਇਸ ਕਰਕੇ ਉਸ ਦਿਨ ਮੈਂ ਬਚ ਗਈ ਸੀ ਅਤੇ ਇਸਨੂੰ ਆਪ ਆਪਣੀ ਗਲਤੀ ਨੂੰ ਇਸ ਤਰ੍ਹਾਂ ਮੈਂ ਸੰਭਾਲ ਲਿਆ ਸੀ